ਕੀ ਤੁਸੀਂ ਸਕੂਲ ਜਾਂ ਕਾਲਜ ਵਿੱਚ ਭਾਰਤੀ ਵਿਗਿਆਨੀਆਂ ਬਾਰੇ ਸਿੱਖਿਆ ਹਾਂ ਮੈਂ ਸਕੂਲ ਵਿੱਚ ਭਾਰਤੀ ਵਿਗਿਆਨੀਆਂ ਬਾਰੇ ਸਿੱਖਿਆ ਜਿਹਨਾਂ ਵਿੱਚ ਸਾਨੂੰ ਵਿਗਿਆਨੀਆਂ ਬਾਰੇ ਦੱਸਿਆ ਗਿਆ ਉਹਨਾਂ ਵਿੱਚੋਂ ਏ ਪੀ ਜੇ ਅਬਦੁਲ ਕਲਾਮ ਨੂੰ ਮਜਾਇਲ ਮੈਨ ਵੀ ਕਿਹਾ ਜਾਂਦਾ ਹੈ ਭਾਰਤੀ ਮਜਾਇਲ ਦਾ ਸਾਰਾ ਪ੍ਰੋਗਰਾਮ ਉਹਨਾਂ ਦੀ ਦੇਖ ਰੇਖ ਵਿੱਚ ਕੀਤਾ ਜਾਂਦਾ ਸੀ ਸਰਦਾਰ ਮਨਮੋਹਨ ਸਿੰਘ ਗਣਿਤ ਸਾਸ਼ਤਰੀਆਂ ਵਿੱਚੋਂ ਇੱਕ ਹਨ ਜੋ ਵਰਲਡ ਬੈਂਕ ਦੇ ਪ੍ਰਧਾਨ ਵੀ ਰਹੇ ਹਨ ਉਹ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਵੀ ਕਈ ਸਾਲ ਕਾਰਜਕਾਲ ਵਿੱਚ ਰਹੇ ਹਨ ਇਸ ਤੋਂ ਬਿਨਾ ਸੀ ਵੀ ਰਮਨ ਹਰਗੋਬਿੰਦ ਖੁਰਾਣਾ ਮਦਰ ਟਰੀਸਾ ਸੁਬਰ ਮੰਨੀਅਮ ਚੰਦਰ ਸ਼ੇਖਰ ਅਮ੍ਰਿਤ ਮੈਂ ਸੈਨ ਬਕੇਤ ਰਮਨ ਰਾਮਾ ਕ੍ਰਿਸ਼ਨ ਕੈਲਾਸ਼ ਸੰਤਜਾਤਸੀ ਮੰਨੇ ਪ੍ਰਮੰਨੇ ਨੋਬਲ ਪੁਰਸਕਾਰ ਵਿਜੇਤਾ ਵਿਗਿਆਨਕ ਹਨ